ਹਾਂਜੀ ਡਾਂਸ ਬਹੁਤ ਚੰਗਾ ਲੱਗਦਾ ਹੈ ਹਾਂਜੀ ਘਰਾਂ ਵਿੱਚ ਬੱਚੇ ਬਹੁਤ ਡਾਂਸ ਕਰਦੇ ਹੈ ਅਸੀਂ ਬੈਠੇ ਦੇਖਦੇ ਰਹਿੰਦੇ ਹਾਂ ਸਾਡਾ ਇਹੋ ਹੀ ਕੰਮ ਹੈ ਹਾਂਜੀ ਨਹੀਂ ਨਹੀਂ ਇਹ ਡਾਂਸ ਡਾਂਸ ਦੇਖਦੇ ਹਾਂ ਅਸੀਂ ਹਾਂਜੀ ਭੰਗੜੇ ਵਾਲੇ ਵੀ ਅ ਦੇਖਦੇ ਹਾਂ ਹਾਂ ਭੰਗੜੇ ਵਾਲੇ ਸਾਨੂੰ ਬਹੁਤ ਚੰਗੇ ਲੱਗਦੇ ਅਸੀਂ ਬੈਠੇ ਦੇਖਦੇ ਰਹਿੰਦੇ ਹਾਂ ਹਾਂਜੀ ਹਾਂਜੀ ਅਸੀਂ ਵੀ ਦੇਖਦੇ ਹਾਂ ਸਾਡੇ ਬੱਚੇ ਬੜੇ ਖੁਸ਼ ਹੁੰਦੇ ਹੈ ਅਸੀਂ ਵੀ ਬੜੇ ਖੁਸ਼ ਹੁੰਦੇ ਹਾਂ ਦੇਖ ਦੇਖ ਹਾਂਜੀ ਅਸੀਂ ਵੀ ਬੈਠੇ ਦੇਖਦੇ ਰਹਿੰਦੇ ਹਾਂ ਬੱਚੇ ਕਰਦੇ ਰਹਿੰਦੇ ਆ ਹਾਂਜੀ ਬਹੁਤ ਵਧੀਆ ਲੱਗਦਾ ਬੜਾ ਮਨ ਖੁਸ਼ ਹੋ ਜਾਂਦਾ